ਸਾਡੇ ਦੇਸ਼ ਵਿੱਚ ਖੇਡਣ ਦੇ ਬਹੁਤ ਹੀ ਵਧੀਆ ਸ਼ਖਸ਼ੀਅਤ ਦੇ ਲੋਕ ਸਨ ਜਿਹਨਾਂ ਨੇ ਬਹੁਤ ਹੀ ਵਧੀਆ ਆਪਣੀ ਮਤਲਬ ਛਾਪ ਛੱਡੀ ਹੈ ਜਿਹਨਾਂ ਨੇ ਖੇਡਾਂ ਨੂੰ ਬਹੁਤ ਹੀ ਵਧੀਆ ਮਹੱਤਵ ਦਿੱਤਾ ਹੈ ਜਿਹਦੇ ਨਾਲ ਕਿ ਇਹ ਲੋਕਾਂ ਦਾ ਬਹੁਤ ਹੀ ਵਧੀਆ ਫਿਊਚਰ ਬਣਿਆ ਕੈਰੀਅਰ ਬਣਿਆ ਜਿਵੇਂ ਕਿ ਵਧੀਆ ਨੈਸ਼ਨਲ ਲੈਵਲ 'ਤੇ ਜਿਹੜੇ ਖੇਡਾਂ ਖੇਡਦੇ ਸਨ ਨੈਸ਼ਨਲ ਪੱਧਰ 'ਤੇ ਜਾਂ ਮਤਲਬ ਆਪਣੇ ਮਤਲਬ ਵਧੀਆ ਮਤਲਬ ਜ਼ਿਲ੍ਹਾ ਲੈਵਲ 'ਤੇ ਜਿਹੜੇ ਖੇਡਾਂ ਖੇਡਦੇ ਸਨ ਫਸਟ ਪੁਜ਼ੀਸ਼ਨ ਹਾਸਿਲ ਕਰਦੇ ਸਨ ਉਹਨਾਂ ਨੂੰ ਵਧੀਆ ਨੌਕਰੀਆਂ ਮਿਲ ਜਾਂਦੀਆਂ ਸਨ ਆਪਦੀ ਖੇਡਾਂ ਦੇ ਤੌਰ 'ਤੇ ਵਧੀਆ ਮਤਲਬ ਆਪਣੀ ਸਰਕਾਰੀ ਜਾਂ ਪ੍ਰਾਈਵੇਟ ਜੋਬ ਕਰ ਲੈਂਦੇ ਸਨ ਜਾਂ ਫਿਰ ਜਿਹੜੇ ਹੁੰਦੇ ਸਨ ਜਿਹਨਾਂ ਦੀ ਮਤਲਬ ਵਧੀਆ ਖੇਡਾਂ ਵਿੱਚ ਰੁਚੀ ਹੁੰਦੀ ਹੈ ਜਾਂ ਕੋਈ ਫੁੱਟਬਾਲ ਹੋ ਗਿਆ ਜਿਹੜੀ ਮਤਲਬ ਵਧੀਆ ਖੇਡਾਂ ਵਿੱਚ ਰੁਚੀ ਹੁੰਦੀ ਹੈ ਉਹਨਾਂ ਨੂੰ ਉਸੇ ਖੇਡ ਦੀ ਮਤਲਬ ਉਹ ਕਰਕੇ ਅਤੇ ਵਧੀਆ ਮਤਲਬ ਖਿਡਾਰੀ ਬਣਾ ਕੇ ਉਸੇ ਕੋਚਿੰਗ ਦੇ ਮਤਲਬ ਟੀਚਰ ਬਣ ਜਾਂਦੇ ਆ ਕੋਚ ਬਣਾਏ ਜਾਂਦੇ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਵਿੱਚ ਜੋਬ ਕਰ ਲੈਂਦੇ ਸਨ ਅਤੇ ਇਹਦੇ ਵਿੱਚ ਜਿਹੜਾ ਕਿ ਖੇਡਾਂ ਦੇ ਵਿੱਚ ਜਿਵੇਂ ਕਿ ਮੇਰਾ ਇੱਕ ਕਜ਼ਨ ਹੈ ਜਿਵੇਂ ਕਿ ਮੇਰੇ ਮਾਮਾ ਜੀ ਦਾ ਬੇਟਾ ਜਿਸ ਨੇ ਫੁੱਟਬਾਲ ਵਿੱਚ ਆਪਣਾ ਕਰੀਅਰ ਬਣਾਇਆ ਹੈ ਵਧੀਆ ਉਸਨੇ ਪਲੱਸ ਟੂ ਤੋਂ ਬਾਅਦ ਇਸੇ ਚੀਜ਼ 'ਤੇ ਫੋਕਸ ਕੀਤਾ ਅਤੇ ਉਸਨੇ ਫੁੱਟਬਾਲ ਖੇਡ ਕੇ ਆਪਣਾ ਕਰੀਅਰ ਬਣਾਇਆ ਉਸਨੇ ਨੈਸ਼ਨਲ ਲੈਵਲ 'ਤੇ ਫਸਟ ਪ੍ਰਾਈਜ਼ ਹਾਸਲ ਕਰਕੇ ਉਸ ਨੇ ਇਹਦੇ ਵਿੱਚ ਅੱਗੇ ਪੜ੍ਹਾਈ ਕੀਤੀ ਅੱਗੇ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਇਹਦੇ ਵਿੱਚ ਕੋਚਿੰਗ ਟੀਚਰ ਕੀਤਾ ਜਿਹਦੇ ਵਿੱਚ ਉਹਦੀ ਟੀਚਰ ਟੀਚਿੰਗ ਦੇ ਵਿੱਚ ਉਹ ਅੱਗੇ ਵੱਖ ਵੱਖ ਖਿਡਾਰੀਆਂ ਨੂੰ ਇਸ ਖੇਡ ਬਾਰੇ ਦੱਸਦਾ ਖੇਡਾਂ ਨੂੰ ਆਪਣੀ ਇਹ ਜ਼ਿੰਦਗੀ ਬਣਾਉਣ ਮਤਲਬ ਖੇਡਾਂ ਨੂੰ ਆਪਦੇ ਜ਼ਿੰਦਗੀ ਵਿੱਚ ਸ਼ਾਮਿਲ ਕਰਨ ਵਾਸਤੇ ਪ੍ਰੇਰਿਤ ਕਰਦਾ ਹੈ